ਇਸ ਸਮੇਂ ਪੰਜਾਬ ਦਾ ਮੌਸਮ ਬਹੁਤ ਜ਼ਿਆਦਾ ਵਧੀਆ ਹੈ ਜੇਕਰ ਇੱਥੇ ਲੋਕਾਂ ਨੇ ਘੁੰਮਣ ਆਉਣਾ ਤਾਂ ਉਹਨਾਂ ਨੂੰ ਸਰਦੀਆਂ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਸਰਦੀਆਂ ਵੇਲੇ ਪੰਜਾਬ ਦਾ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਸਰਦੀਆਂ ਵੇਲੇ ਲੋਕ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਜ ਖਾਣੀ ਜ਼ਿਆਦਾ ਪਸੰਦ ਕਰਦੇ ਹਨ ਅਤੇ ਜੋ ਵੀ ਇੱਥੇ ਘੁੰਮਣ ਆਉਂਦਾ ਉਹਨਾਂ ਨੂੰ ਵੀ ਪੰਜਾਬ ਦਾ ਖਾਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਉਹਨਾਂ ਨੂੰ ਇਹ ਖਾਣਾ ਬਹੁਤ ਪਸੰਦ ਆਉਂਦਾ ਅਤੇ ਇੱਥੇ ਦੇ ਲੋਕ ਸਰਦੀਆਂ ਵਿੱਚ ਪਿੰਨੀਆਂ ਵੀ ਬਣਾਉਂਦੇ ਹਨ ਅਤੇ ਦੇਸੀ ਘਿਉ ਵੀ ਜ਼ਿਆਦਾ ਖਾਂਦੇ ਹਨ ਜਿਸ ਨਾਲ਼ ਉਹਨਾਂ ਉਹ ਉਹਨਾਂ ਨੂੰ ਠੰਡ ਵੀ ਜ਼ਿਆਦਾ ਨਹੀਂ ਲੱਗਦੀ ਅਤੇ ਉਹ ਸਰ੍ਹੋਂ ਦਾ ਸਾਗ ਵੀ ਬਹੁਤ ਬਣਾਉਂਦੇ ਹਨ ਅਤੇ ਉਹ ਲੱਸੀ ਵੀ ਪੀਂਦੇ ਹਨ ਅਤੇ ਪੰਜਾਬ ਵਿੱਚ ਇਸ ਸਮੇਂ ਪੰਜਾਬ ਦੇ ਪਿੰਡ ਵੀ ਬਹੁਤ ਸੁੰਦਰ ਲੱਗਦੇ ਹਨ ਉੱਥੇ ਦੇ ਖੇਤ ਬਹੁਤ ਚੰਗੇ ਲੱਗਦੇ ਹਨ